ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਵਾਜਾਈ ਦੇ ਮੁੱਖ ਵਿਕਲਪ ਬਹੁਤ ਹਨ ਜਿਵੇਂ ਕਿ ਸੜਕਾਂ ਰੇਲਵੇ ਹਵਾਈ ਅੱਡੇ ਜਨਤਕ ਹਵਾਈ ਆਵਾਜਾਈ ਇੱਕ ਮਨੁੱਖ ਵਾਸਤੇ ਐਹ ਵਿਕਲਪ ਬੋ ਸਸਤੇ ਵੀ ਹਨ ਅਤੇ ਮਹਿੰਗੇ ਵੀ ਹਨ ਉਹ ਉਹਨਾਂ 'ਤੇ ਡਿਪੈਂਡ ਕਰਦਾ ਹੈ ਕਿ ਉਹ ਉਹਨਾਂ ਦੀ ਦੂਰੀ ਕਿੰਨ ਕਦੋਂ ਤੱਕ ਹੈਗੀ ਆ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਵਿੱਚ ਔਟੋ ਵਾਲਿਆਂ ਨੇ ਯੂਨੀਅਨ ਬਣਾਈ ਹੁੰਦੀ ਹੈ ਉਹਨਾਂ ਨੇ ਹੜ ਇੱਕ ਕਿ ਰੇਟ ਆਪਾਂ ਇੰਨੇ ਫਿਕਸ ਕੀਤੇ ਹੁੰਦੇ ਆ ਉਹ ਇੱਕ ਆਮ ਬੰਦੇ ਲਈ ਬਹੁਤ ਹੀ ਔਖਾ ਹੋ ਸਕਦਾ ਬਟ ਜੇ ਆਪਾਂ ਸਸਤੇ ਵੱਲ ਜਾਈਏ ਤਾਂ ਸਾਨੂੰ ਕਈ ਕਈ ਕਾਫੀ ਲੰਮੇ ਰਸਤੇ ਵਸਤੇ ਵੀ ਇੱਕ ਬੇ ਆਰ ਟੀ ਸੀ ਦੀ ਬਸਿਸ ਹੈਗੀਆਂ ਅਤੇ ਓਦਾਂ ਵੀ ਸਾਨੂੰ ਬਹੁਤ ਸਹੂਲਤਾਂ ਮਿਲਦੀਆਂ ਹਨ ਹੁਣ ਅਗਰ ਆਪਾਂ ਵੇਖੀਏ ਜਾਈਏ ਕਿ ਬੱਸਾਂ ਵਿੱਚ ਇੱਕ ਔਰਤ ਵਾਸਤੇ ਆਧਾਰ ਕਾਰਡ ਦੀ ਉਹ ਆਧਾਰ ਕਾਰਡ ਵਿਖਾ ਕੇ ਉਹ ਫਰੀ ਜਾ ਸਕਦੀਆਂ ਹਨ ਐਹ ਸੇਵਾ ਸਾਡੇ ਇਹਨਾਂ ਲਈ ਬਹੁਤ ਵਧੀਆ ਕੀਤੀ ਗਈ ਹੈ ਉਹ ਹੋਰ ਵੀ ਫੈਸਿਲਿਟੀਜ਼ ਦਿੱਤੀ ਗਈ ਹੈ ਸਰਕਾਰੀ ਬੱਸਾਂ ਹੈਗੀਆਂ ਹਨ ਪ ਅਤੇ ਜੇ ਆਪਾਂ ਅੰਮ੍ਰਿਤਸਰ ਵਿੱਚ ਈ ਰਿਕਸ਼ਾ ਹੈਗੀਆਂ ਹੈ ਕਈ ਔਟੋ ਹੈਗੇ ਆ ਅਤੇ ਉਹਨਾਂ ਵਿੱਚ ਜਾਣਾ ਬਹੁਤ ਹੀ ਸਸਤਾ ਪੈਂਦਾ ਜੇ ਆਪਾਂ ਆਪਣੇ ਪ ਪਰਸਨਲ ਵਹੀਕਲ 'ਤੇ ਜਾਈਏ ਤਾਂ ਸਾਨੂੰ ਪੈਟਰੋਲ ਬਹੁਤ ਮਹਿੰਗਾ ਪੈਂਦਾ ਹੈ ਬਟ ਜੇ ਆਪਾਂ ਔਟੋਜ਼ ਵਗੈਰਾ ਲਈਏ ਤਾਂ ਸਾਨੂੰ ਥੋੜ੍ਹੇ ਦੂਰ ਕਾਫੀ ਦੂਰ ਤੱਕ ਦੇ ਕਾਫੀ ਸਸਤੇ ਵਿੱਚ ਆਪਾਂ ਜਗ੍ਹਾ 'ਤੇ ਪਹੁੰਚ ਜਾਂਦੇ ਹਨ ਜਿਵੇਂ ਹੁਣ ਸਾਨੂੰ ਆਵਾਜਾਈ ਵਿੱਚ ਏਰੋਪਲੇਨ ਹੈਗਾ ਹੈ ਕਿੱਥੇ ਆਪਾਂ ਦੂਰ ਜਾਣਾ ਹੈਗਾ ਤਾਂ ਆਪਾਂ ਮਿੰਟਾਂ ਵਿੱਚ ਪਹੁੰਚ ਜਾਂਦੇ ਹਨ ਐਹ ਸਾਨੂੰ ਬਹੁਤ ਹੀ ਲਾਭਕਾਰੀ ਅਤੇ ਬਹੁਤ ਵਧੀਆ ਚੀਜ਼ ਹੈਗੀ ਆ ਹੁਣ ਬੱਸਾਂ 'ਚ ਜਾਣਾ ਹੋਵੇ ਤਾਂ ਬਹੁਤ ਹੀ ਸਸਤੇ ਕਰਾਇਆ ਦਿੱਤਾ ਗਿਆ ਅਤੇ ਕਾਫੀ ਦੂਰ ਤੱਕ ਕਈਆਂ ਨੂੰ ਫਰੀ ਹੈ ਮੇਨਲੀ ਔਰਤਾਂ ਨੂੰ ਫਰੀ ਕੀਤਾ ਗਿਆ ਹੈ ਅਤੇ ਬਾਕੀਆਂ ਵਾਸਤੇ ਵੀ ਬਹੁਤ ਲਿਮਿਟਿਡ ਜਿਹਾ ਕਰਾਇਆ ਕੀਤਾ ਗਿਆ ਹੁਣ ਆਪਾਂ ਰੇਲਵੇ ਦੀ ਵੇਖਿਆ ਜਾਵੇ ਤਾਂ ਰੇਲਵੇ ਦੀ ਬਹੁਤ ਹੀ ਫੈਸਿਲਿਟੀ ਕਰ ਦਿੱਤੀ ਗਈ ਹੈ ਹੁਣ ਜਿਸ ਤਰ੍ਹਾਂ ਵੰਦੇ ਮਾਤਰਮ ਚਲਾ ਦਿੱਤੀ ਗਈ ਹੈ ਉਹ 'ਚ ਇੰਨੀ ਕੁ ਫੈਸਿਲਿਟੀ ਹੈਗੀ ਖਾਣ ਪੀਣ ਦਾ ਬਹੁਤ ਵਧੀਆ ਹੈਗਾ ਅਤੇ ਆਪਾਂ ਜਿਹੜਾ ਸਫ਼ਰ ਨੌਂ ਘੰਟਿਆਂ 'ਚ ਤੈਅ ਹੁੰਦਾ ਉਹ ਕੀ ਹਾਲਾਂਕਿ ਸਾਡਾ ਛੇ ਘੰਟਿਆਂ 'ਚ ਪੂਰਾ ਹੋ ਜਾਂਦਾ ਹੁਣ ਸ਼ਤਾਬਦੀ ਹੈਗੀ ਹੈ ਕੋਈ ਸਾਡੀ ਗਰੀਬ ਰਾਹ ਚਲਾਇਆ ਗਿਆ ਉਹ ਵੀ ਸਵੇਰੇ ਚਲਦੀ ਹੈ ਉਹਦੇ ਵਿੱਚ ਹੈ ਏ ਸੀ ਤੁਹਾਨੂੰ ਮਿਲੇਗਾ ਪਰ ਆਪਾਂ ਘੱਟ ਕਿਰਾਏ 'ਚ ਆਪਾਂ ਸਾਰੀ ਸੁਵਿਧਾ ਲੈ ਪਾਉਂਦੇ ਹਨ ਉਹ ਵੀ ਟਰੇਨਾਂ ਹੈਗੀਆਂ ਹੁਣ ਹਰ ਇੱਕ ਪਲੇਟਫੋਮ 'ਤੇ ਬਹੁਤ ਜ਼ਿਆਦਾ ਟਰੇਨਾਂ ਚੱਲ ਚੁੱਕੀਆਂ ਹਨ ਕਿਹੜੀਆਂ ਜਿਸ ਤਰ੍ਹਾਂ ਹੁ ਆਪਣੇ ਇਲਾਕੇ ਵਿੱਚ ਵੀ ਇੱਕ ਉਬਰ ਓਲਾ ਦੀ ਫੈਸਿਲਿਟੀ ਹੋ ਗਈ ਹੈ ਅਤੇ ਉਹਨਾਂ ਨੂੰ ਆਪਾਂ ਕਿਤੇ ਵੀ ਜਾ ਕੇ ਔਨਲਾਈਨ ਬੁਕਿੰਗ ਕਰ ਸਕਦੇ ਹਾਂ ਅਤੇ ਉੱਥੋਂ ਬੱਸਿਸ ਅਤੇ ਔਟੋ ਦੀ ਉਹ ਓਲਾ ਆਪਣੀ ਸਾਨੂੰ ਕਾਰ ਆਏਗੀ ਸਪੈਸ਼ਲੀ ਪਿਕਅੱਪ ਕਰਨ ਅਤੇ ਉਹ ਪਿਕ ਕਰਕੇ ਸਾਨੂੰ ਲੈ ਕੇ ਜਾਏਗੀ